ਟੈਕਨੋਲੋਜੀ ਨੇ ਸਾਡਾ ਜੀਵਨ ਬਹੁਤ ਸੁਖਾਲਾ ਕਰ ਦਿੱਤਾ ਹੈ ਜਿਸ ਤਰ੍ਹਾਂ ਸੈਟਲਾਈਟ ਚੱਲ ਰਹੇ ਨੇ ਸਾਡੇ ਉਸ ਦੇ ਜਰੀਏ ਅਸੀਂ ਸਾਡੇ ਮੋਬਾਇਲ ਕੁਨੈਕਟ ਨੇ ਉਹਨਾਂ ਦੇ ਨਾਲ ਮੋਬਾਇਲ ਰਾਹੀਂ ਅਸੀਂ ਵੰਨ ਟੂ ਵੰਨ ਕੋਲਿੰਗ ਕਰ ਰਹੇ ਐ ਉਹ ਵੀ ਸਾਡੇ ਸੈਟਲਾਈਟ ਦੇ ਅਕੋਰਡਿੰਗ ਹੀ ਹੈਂਡਲ ਕਰਦੇ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਮੈਸੇਜ ਕਿਸੇ ਨੂੰ ਕਰਦੇ ਨੇ ਸੈਟਲਾਈਟ ਉਹਨਾਂ ਨੂੰ ਕੰਟਰੋਲ ਕਰਕੇ ਅੱਗੇ ਸੈਂਡਿੰਗ ਕਰਦਾ ਜਿਹੜੀ ਸਾਡੀ ਟੈਕਨੋਲੋਜੀ ਦੀ ਹੀ ਦੇਣ ਹੈ ਟੈਕਨੋਲਜੀ ਦੇ ਖੇਤਰ ਵਿੱਚ ਰਾਸ਼ਟਰੀ ਐਂਡ ਅੰਤਰਰਾਸ਼ਟਰੀ ਪੱਧਰ ਤੇ ਵੀ ਰਲ ਮਿਲ ਕੇ ਇਹ ਕੰਮ ਕਰ ਰਹੇ ਨੇ ਟੈਕਨੋਲੋਜੀ ਦੇ ਕਾਰਨ ਹੀ ਅਸੀਂ ਜਿਸ ਤਰ੍ਹਾਂ ਵੈਦਰ ਅਪਡੇਟ ਕਰ ਰਹੇ ਆਂ ਨਿਊਜ਼ ਰਾਹੀ ਸਾਨੂੰ ਅਪਡੇਟ ਵੀ ਓਨ ਦੀ ਸਪੋਰਟ ਵੀ ਟੈਕਨੋਲੋਜੀ ਦੀ ਦੇਣ ਹੈ ਟੈਕਨੋਲੋਜੀ ਦੇ ਕਾਰਨ ਹੀ ਈਮੇਲ ਆਈਡੀ ਅਸੀਂ ਅਪਗਰੇਡ ਕਰਦੇ ਹਾਂ ਵੈਬ ਡਿਜਾਈਨ ਵੈਬਸਾਈਟ ਕੁਛ ਵੀ ਤਿਆਰ ਕਰਦੇ ਆਂ ਇਹ ਟੈਕਨੋਲੋਜੀ ਦੀ ਹੀ ਦੇਣ ਹੈ ਟੈਕਨੋਲੋਜੀ ਦੀ ਇਨਫੋਰਮੇਸ਼ਨ ਐਂਡ ਸਟਡੀ ਵੀ ਇੰਡੀਆ ਪੱਧਰ ਤੇ ਵੀ ਬਹੁਤ ਵਧੀਆ ਕਾਲਜ ਇੰਸਟੀਚਿਊਟ ਓਪਨ ਕੀਤੇ ਗਏ ਹਨ ਟੈਕਨੋਲੋਜੀ ਦੀ ਸਟੱਡੀ ਕਰਵਾਈ ਜਾ ਰਹੀ ਹੈ ਟੈਕਨੋਲੋਜੀ ਦੇ ਕਾਰਨ ਹੀ ਭਾਰਤ ਦੇਸ਼ ਵੀ ਨਾਸਾ ਨਾਸਾ ਜਿਹੜੀ ਸਾਡੀ ਨਾਸਾ ਦੀ ਟੀਮ ਹੈ ਉਸ ਵਿੱਚ ਵੀ ਭਾਰਤ ਦੇ ਬਹੁਤ ਸਾਰੇ ਵਿਗਿਆਨਿਕ ਕੰਮ ਕਰ ਰਹੇ ਨੇ ਇਹ ਵੀ ਸਾਡੀ ਟੈਕਨੋਲੋਜੀ ਦੀ ਹੀ ਵਜ੍ਹਾ ਹੈ ਭਾਰਤ ਦੇਸ਼ ਇੱਕ ਟੈਕਨੋਲੋਜੀ ਦੇ ਮੁਕਾਬਲੇ ਪੂਰੇ ਵਰਲਡ ਵਿਚ ਅੱਗੇ ਰਾਹ ਵਿੱਚ ਚੱਲ ਰਿਹਾ ਹੈ ਟੈਕਨੋਲੋਜੀ ਦੇ ਕਾਰਨ ਹੀ ਅਸੀਂ ਕੁਝ ਵੀ ਨਿਊਜ਼ ਚੈਨਲ ਹੈ ਨਿਊਜ਼ ਚੈਨਲ ਬਾਰੇ ਸਾਡੇ ਅੱਜ ਕੱਲ ਟੀਵੀ ਡਿਸ਼ ਲੱਗੀ ਹੋਈ ਹੈ ਡਿਸ਼ ਟੀਵੀ ਐ ਡੀ ਟੀ ਐਚ ਐ ਡੀ ਟੂ ਵੀਡੀਓ ਕੌਨ ਹੈ ਉਹ ਵੀ ਟੈਕਨੋਲੋਜੀ ਦੀ ਹੀ ਦੇਣ ਹੈ ਟੈਕਨੋਲੋਜੀ ਦੇ ਕਾਰਨ ਹੀ ਅਸੀਂ ਆਪਣਾ ਜੀਵਨ ਇਨਾ ਸੁਖਾਲਾ ਕਰ ਲਿਆ ਮੋਬਾਈਲ ਯੂਜ ਕਰ ਰਹੇ ਆਂ ਮੋਬਾਈਲ ਤੇ ਯੂ ਮੀਟਿੰਗ ਆਫਿਸ ਦੀ ਮੀਟਿੰਗ ਸਟੱਡੀ ਜੋ ਵੀ ਅੱਜ ਟੈਕਨੋਲੋਜੀ ਦੀ ਹੀ ਦੇਣ ਹੈ ਟੈਕਨੋਲੋਜੀ ਦਾ ਜਿਹੜਾ ਸਫਰ ਹੈ ਭਾਰਤ ਵਿੱਚ ਬਹੁਤ ਵਧੀਆ ਚੱਲ ਰਿਹਾ ਹੈ